ਸਤਿ ਸ਼੍ਰੀ ਅਕਾਲ ਜੀ ਮੈਂ ਰਮਨ ਤੁਹਾਡੀ ਵੈੱਬਸਾਈਟ ਤੋਂ ਦੂਜੀ ਵਾਰੀ ਰ ਖਰੀਦਦਾਰੀ ਕਰ ਰਹੀ ਹਾਂ ਮੈਂ ਪਹਿਲਾਂ ਜੋ ਲਿਆ ਸੀ ਉਹ ਬਹੁਤ ਵਧੀਆ ਨਿਕਲਿਆ ਮੈਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਪਰ ਇਸ ਵਾਰ ਜਿਹੜੇ ਕੁਰਸੀਆਂ ਦੇ ਕੱਪੜੇ ਮੰਗਵਾਏ ਉਹਨਾਂ ਦੀ ਕੁਆਲਿਟੀ ਬਹੁਤ ਡਾਊਨ ਹੈ ਉਹਨਾਂ ਦਾ ਤਾਂ ਰੰਗ ਵੀ ਫਿੱਟਿਆ ਹੋਇਆ ਹੈ ਅਤੇ ਜੋ ਰੰਗ ਅਤੇ ਪੀਸ ਮੈਂ ਵੇਖ ਕੇ ਔਡਰ ਕੀਤੇ ਸਨ ਇਹ ਉਸ ਤਰ੍ਹਾਂ ਦੇ ਬਿਲਕੁਲ ਵੀ ਨਹੀਂ ਹਨ ਇਹਨਾਂ ਨੂੰ ਮੈਂ ਫਿਰ ਵੀ ਕੁਰਸੀਆਂ 'ਤੇ ਚੜ੍ਹਾ ਲੈਂਦੀ ਪਰ ਇਹਨਾਂ ਦੀ ਲਾਸਟਿਕ ਵੀ ਢਿੱਲੀ ਹੈ ਅਤੇ ਜੋ ਜੋ ਕੱਪੜਾ ਲੱਗਾ ਕੱਪੜੇ 'ਤੇ ਸੀਣਾ ਨੇ ਉਹ ਵੀ ਬਹੁਤ ਹੀ ਵੱਡੇ ਵੱਖੇ ਨਾਲ ਨੇ ਜੋ ਪਾਉਂਦਿਆਂ ਹੀ ਉੱਧੜ ਜਾਣਗੀਆਂ ਮੈਂ ਇਹਨਾਂ ਨੂੰ ਵਾਪਸ ਕਰਨਾ ਚਾਹੁੰਦੀ ਹਾਂ ਧੰਨਵਾਦ